ਕਲਾ ਦਾ ਮੈਨੂੰ ਸ਼ੁਰੂ ਤੋਂ ਹੀ ਸ਼ੌਕ ਰਿਹਾ ਕਹਿ ਲਉ ਕਿ ਮੈਨੂੰ ਬਚਪਨ ਤੋਂ ਹੀ ਡਰਾਇੰਗ ਦਾ ਬਹੁਤ ਸ਼ੌਕ ਰਿਹਾ ਵਿਆਹ ਤੋਂ ਪਹਿਲਾਂ ਮੈਂ ਜਦੋਂ ਵੀ ਫਰੀ ਹੋਣਾ ਤਾਂ ਮੈਂ ਕੋਈ ਨਾ ਕੋਈ ਕਹਿ ਲਉ ਪੇਂਟਿੰਗ ਕੋਈ ਸਿਲਾਈ ਕਢਾਈ ਕੁਛ ਨਾ ਕੁਛ ਕਰਦੀ ਰਹਿੰਦੀ ਸੀ ਜਿਸ ਤਰ੍ਹਾਂ ਕਿ ਮੈਂ ਵਿਆਹ ਤੋਂ ਪਹਿਲਾਂ ਕਾਫੀ ਸਾਰੇ ਪੇਂਟਿੰਗ ਬਣਾਈਆਂ ਨੇ ਜਿਸ ਤਰ੍ਹਾਂ ਨਿਬ ਪੇਂਟਿੰਗ ਫੈਬਰਿਕ ਪੇਂਟਿੰਗ ਕਲੇਅ ਪੇਂਟਿੰਗ ਕਾਫੀ ਸਾਰੇ ਫਲਾਵਰਸ ਬਣਾਏ ਨੇ ਜੇ ਮਤਲਬ ਕਿਉਂਕਿ ਮੈਨੂੰ ਸ਼ੌਕ ਬਹੁਤ ਸੀਗਾ ਕਿ ਮੈਂ ਜਦੋਂ ਵੀ ਫਰੀ ਹੋਵਾਂ ਤਾਂ ਮਤਲਬ ਫਰੀ ਤਾਂ ਆਪਣਾ ਟਾਈਮ ਸਪੈਂਡ ਕਰਾਂ ਕੁਛ ਨਾ ਕੁਛ ਕਰਾਂ ਇਸ ਤੋਂ ਇਲਾਵਾ ਮੈਂ ਬਹੁਤ ਸਾਰੇ ਪੋਟ ਵੀ ਪੇਂਟ ਕੀਤੇ ਸੀ ਇੱਥੋਂ ਤੱਕ ਕਿ ਜਦੋਂ ਵੀ ਮੈਂ ਆਪਣੇ ਕੋਲਜ ਲਾਈਫ ਦੀ ਗੱਲ ਕਰਾਂ ਤਾਂ ਜਦੋਂ ਵੀ ਕਾਲਜ 'ਚ ਕੋਈ ਕੰਪਟੀਸ਼ਨ ਹੁੰਦਾ ਸੀ ਡਰਾਇੰਗ ਦਾ ਰੰਗੋਲੀ ਦਾ ਜਾਂ ਪੋਟ ਦਾ ਤਾਂ ਉਹਦੇ 'ਚ ਮੈਂ ਫਸਟ ਪੁਜ਼ੀਸ਼ਨ ਹਾਸਲ ਕੀਤੀ ਸੀ ਤਾਂ ਸੋ ਜਿਹੜੀ ਇੱਕ ਕਲਾ ਆ ਇਹ ਮਤਲਬ ਇੱਕ ਇਨਸਾਨ ਨੂੰ ਕਿਤੇ ਨਾ ਕਿਤੇ ਲੈ ਕੇ ਆ ਜਾਂਦੀ ਹੈ ਅਤੇ ਕਲਾ ਦਾ ਹੋਣਾ ਬਹੁਤ ਜ਼ਰੂਰੀ ਹੈ